ਹਾਂਜੀ ਬਹੁਤ ਜ਼ਿਆਦਾ ਵਿਲੱਖਣ ਪਕਵਾਨ ਜੋ ਕਿ ਸਾਡੇ ਅੱਜ ਕੱਲ੍ਹ ਦੇ ਪਕਵਾਨ ਦਾ ਹਿੱਸਾ ਬਣ ਗਏ ਹਨ ਸਾਡੇ ਘਰ ਦੇ ਵਿੱਚ ਜ਼ਿਆਦਾਤਰ ਮਾਤਰਾ ਦੇ ਵਿੱਚ ਮੀਂਹ ਵਾਲੇ ਦਿਨਾਂ ਵਿੱਚ ਅ ਪਕਵਾਨ ਬਣਾਏ ਜਾਂਦੇ ਹਨ ਜਿਵੇਂ ਕਿ ਕਚੋਰੀਆਂ ਅਤੇ ਗੁਲਗੁਲੇ ਇਸ ਦੇ ਵਿੱਚ ਬਹੁਤ ਜ਼ਿਆਦਾ ਮਸਾਲੇ ਪਾ ਕੇ ਇਸ ਨੂੰ ਬਹੁਤ ਸਵਾਦਿਸ਼ਟ ਬਣਾਇਆ ਜਾਂਦਾ ਹੈ ਅਤੇ ਦੂਜੇ ਪਾਸੇ ਠੰਡਾ ਦੇ ਦਿਨਾਂ ਵਿੱਚ ਅਸੀਂ ਪਿੰਨੀਆਂ ਅਤੇ ਪੰਜੀਰੀ ਬਣਾਉਂਦੇ ਹਨ ਜਿ ਜਿਸ ਵਿੱਚ ਖੰਡ ਦੀ ਮਾਤਰਾ ਵਧੇਰੇ ਪਾ ਕੇ ਇਸਨੂੰ ਹੋਰ ਵੀ ਸਵਾਦਿਸ਼ਟ ਬਣਾਇਆ ਜਾਂਦਾ ਹੈ ਅਤੇ ਇਸ ਵਿੱਚ ਬਹੁਤ ਜ਼ਿਆਦਾ ਹੋਰ ਵੀ ਚੀਜ਼ਾਂ ਪਾਈਆਂ ਜਾਂਦੀਆਂ ਹਨ ਜੋ ਕਿ ਸਰੀਰ ਦੇ ਲਈ ਲਾਹੇਵੰਦ ਹੁੰਦੀਆਂ ਹਨ ਅਤੇ ਇਹ ਸਾਰੀਆਂ ਚੀਜ਼ਾਂ ਹੀ